ਪਿਛਲੇ ਕੁਝ ਦਹਾਕਿਆਂ ਦੌਰਾਨ ਭਾਰਤ ਵਿੱਚ ਬਹੁਤ ਹੀ ਨਵੇਂ ਪ੍ਰਕਾਰ ਦੇ ਕਿੱਤੇ ਆਏ ਨੇ ਜਿਹਨਾਂ ਵਿੱਚ ਆਪਾਂ ਕਹਿ ਸਕਦੇ ਹਾਂ ਇੱਕ ਯੂਟਿਊਬ ਨੇ ਬੜਾ ਹੀ ਪ੍ਰਚਲਿਤ ਹੋਇਆ ਹੈ ਜਿਹਦੇ ਦੌਰਾਨ ਕਾਫੀ ਲੋਕਾਂ ਨੇ ਇਸ ਯੂਟਿਊਬ ਤੋਂ ਆਪਣਾ ਇੱਕ ਰੁਜ਼ਗਾਰ ਪੈਦਾ ਕੀਤਾ ਹੈ ਜਿਹਦੇ ਨਾਲ ਉਹ ਯੂਟਿਊਬ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਰੀਲਾਂ ਅੱਪਲੋਡ ਕਰਦੇ ਨੇ ਅਤੇ ਉਹਨਾਂ ਤੋਂ ਪੈਸੇ ਕਮਾਉਂਦੇ ਨੇ ਕੁਝ ਲੋਕ ਜਿਹੜੇ ਕਿ ਪੜ੍ਹੇ ਲਿਖੇ ਨੇ ਉਹ ਘਰ ਬੈਠੇ ਹੀ ਪੜ੍ਹਾਈ ਦੀਆਂ ਵੀਡਿਓਆਂ ਬਣਾ ਕੇ ਨੈੱਟ ਦੇ ਉੱਤੇ ਯੂਟਿਊਬ ਦੇ ਉੱਤੇ ਅੱਪਲੋਡ ਕਰ ਦਿੰਦੇ ਨੇ ਜਿਹਨਾਂ ਨਾਲ ਜਿਹੜੇ ਘਰ ਬੈਠੇ ਬੱਚੇ ਨੇ ਜਿਹੜੇ ਸਕੂਲ ਕਾਲਜ ਨਹੀਂ ਜਾ ਸਕਦੇ ਉਹ ਉੱਥੇ ਤੋਂ ਉਹ ਵੀਡਿਓਆਂ ਦੇਖ ਕੇ ਆਪਣੀ ਪੜ੍ਹਾਈ ਨੂੰ ਪੂਰਾ ਕਰ ਸਕਦੇ ਹਾਂ ਅਤੇ ਪੜ੍ਹ ਲਿਖ ਸਕਦੇ ਨੇ ਅਤੇ ਹੁਣ ਇਸ ਦੌਰਾਨ ਇਸ ਸਮੇਂ ਦੌਰਾਨ ਫ਼ੋਨ ਕਾਫੀ ਸਮਾਰਟ ਫ਼ੋਨ ਕਾਫੀ ਪ੍ਰਚਲਿਤ ਹੋਏ ਨੇ ਜਿਨ੍ਹਾਂ ਦੇ ਦੌਰਾਨ ਵੀ ਕਾਫੀ ਜਿਸਦੇ ਨਾਲ ਵੀ ਕਾਫੀ ਲੋਕਾਂ ਨੇ ਇੱਕ ਰੁਜ਼ਗਾਰ ਦਾ ਸਾਧਨ ਬਣਾਇਆ ਹੈ ਹੁਣ ਅੱਜ ਕੱਲ੍ਹ ਟੈਕਨੋਲੋਜੀ ਦਾ ਜਮ ਜ਼ਮਾਨਾ ਹੈ ਅਤੇ ਸਮਾਰਟ ਫ਼ੋਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਐਪਾਂ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਘਰ ਬੈਠੇ ਹੀ ਕਿਸੇ ਵੀ ਜਗ੍ਹਾ ਦਾ ਮੈਪ ਦੇਖ ਸਕਦੇ ਹਾਂ ਕੁਛ ਵੀ ਮੰਗਾ ਸਕਦੇ ਹਾਂ ਔਨਲਾਈਨ ਪੇਮੈਂਟਾਂ ਕਰ ਸਕਦੇ ਹਾਂ ਸਾਰਾ ਕੁਛ ਕਰ ਸਕਦੇ ਹਾਂ ਇਹਦੇ ਨਾਲ ਨਾਲ ਇਹ ਜਿਹੜੀਆਂ ਐਪਾਂ ਨੇ ਇਹਨਾਂ ਤੋਂ ਕਾਫੀ ਲੋਕਾਂ ਨੇ ਇੱਕ ਪੈਸੇ ਕਮਾਉਣ ਦਾ ਇੱਕ ਸਾਧਨ ਬਣਾ ਲਿਆ ਹੈ ਅਤੇ ਭਾਰਤ ਵਿੱਚ ਸਰਕਾਰੀ ਜਿਹੜੀਆਂ ਨੌਕਰੀਆਂ ਨੇ ਇਹ ਬਹੁਤ ਘੱਟ ਨੇ ਜਿਹਨਾਂ ਕਰਕੇ ਅੱਜ ਹੁਣ ਜਿਹੜੇ ਜਿਹੜੇ ਵੀ ਨਵੇਂ ਕਿੱਤੇ ਆ ਰਹੇ ਨੇ ਸਮਾਜ ਦੇ ਵਿੱਚ ਨੌਜਵਾਨ ਉਹਨਾਂ ਕਿੱਤਿਆਂ ਨੂੰ ਅਪਣਾ ਰਹੇ ਨੇ ਅਤੇ ਜੋ ਵੀ ਉਹਨਾਂ ਦੇ ਆਮਦਨ ਆ ਜੋ ਵੀ ਖਾਣਾ ਪਾਣੀ ਆ ਉਹ ਆਪਣਾ ਸ਼ੁਰੂ ਕੀਤਾ ਹੈ ਇਹਨਾਂ ਨਵੇਂ ਕਿੱਤਿਆਂ ਦੇ ਬਦੌਲਤ ਉਹ ਨਵੇਂ ਕਿੱਤਿਆਂ ਦੇ ਵਿੱਚ ਕੰਮ ਕਰਨ ਲੱਗ ਗਏ ਨੇ ਅਤੇ ਪੈਸਾ ਕਮਾ ਰਹੇ ਨੇ ਅਤੇ ਰੋਟੀ ਖਾ ਰਹੇ ਨੇ